ਭੰਗੜਾ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਊਰਜਾ ਅਤੇ ਅਨੰਦ ਦਾ ਇੱਕ ਜੀਵਨਤ ਪ੍ਰਗਟਾਵਾ ਹੈ ਇਹ ਜੀਵਨਤ ਕਲਾ ਦਾ ਰੂਪ ਇਸਦੇ ਰਵਾਇਤੀ ਪਹਿਰਾਵੇ ਤੋਂ ਬਿਨ੍ਹਾਂ ਅਧੂਰਾ ਹੈ ਜੋ ਇਸਦੀ ਸ਼ਾਨ ਨੂੰ ਵਧਾਉਂਦਾ ਹੈ ਭੰਗੜਾ ਪਹਿਰਾਵਾ ਪੰਜਾਬੀ ਕੁੜਤਾ ਪਜਾਮਾ ਜਾਂ ਤੰਬਾ ਅਤੇ ਕੁੜਤਾ ਵਜੋਂ ਜਾਣਿਆ ਜਾਂਦਾ ਹੈ ਜਿਸ ਵਿੱਚ ਇੱਕ ਗੁੰਝਲਦਾਰ ਕਢਾਈ ਵਾਲਾ ਕੁੜਤਾ ਲੰਬੀ ਕਮੀਜ਼ ਢਿੱਲਾ ਫਿਟਿੰਗ ਪਜਾਮਾ ਜਾਂ ਤੰਬਾ ਅਤੇ ਇੱਕ ਫੁਲਕਾਰੀ ਕਢਾਈ ਵਾਲੀ ਵੇਸਟ ਜਾਂ ਜੈਕੇਟ ਸ਼ਾਮਿਲ ਹੁੰਦੀ ਹਨ ਪਹਿਰਾਵੇ ਨੂੰ ਜੀਵਨ ਤਰੰਗਾਂ ਗੁੰਝਲਦਾਰ ਨਮੂਨਿਆਂ ਅਤੇ ਕਲੀਰੇ ਅਤੇ ਪਰਾਂਦੀ ਧਾਗੇ ਦੇ ਸ਼ਿੰਗਾਰ ਵਰਗੇ ਅਲੰਕਾਰਿਕ ਉਪਕਰਨਾਂ ਨਾਲ ਸ਼ਿੰਗਾਰਿਆ ਗਿਆ ਹੈ ਦਸਤਾਰ ਸਿੱਖ ਵਿਰਸੇ ਦਾ ਪ੍ਰਤੀਕ ਭੰਗੜੇ ਦੇ ਪਹਿਰਾਵੇ ਦਾ ਇੱਕ ਜ਼ਰੂਰੀ ਹਿੱਸਾ ਹੈ ਜੋ ਸ਼ਾਨਦਾਰਤਾ ਅਤੇ ਸੱਭਿਆਚਾਰਕ ਮਾਨ ਦੀ ਛੋਹ ਨੂੰ ਜੋੜਦੀ ਹੈ ਜਿਵੇਂ ਜਿਵੇਂ ਨੱਚਣ ਵਾਲੇ ਢੋਲ ਦੀ ਤਾਲ ਦੀ ਧੜਕਣ ਵੱਲ ਵਧਦੇ ਹਨ ਉਹਨਾਂ ਦੇ ਰੰਗੀਨ ਪਹਿਰਾਵੇ ਘੁੰਮਦੇ ਅਤੇ ਚਮਕਦੇ ਹਨ ਇੱਕ ਮਨਮੋਹਕ ਤਮਾਸ਼ਾ ਬਣਾਉਂਦੇ ਹਨ ਜੋ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਿਖਾਉਂਦਾ ਹੈ ਭੰਗੜਾ ਮਨ ਦੀ ਖੁਸ਼ੀ ਲਈ ਵੀ ਆਮ ਪ੍ਰਚਲਿਤ ਹੈ ਭੰਗੜਾ ਪਹਿਰਾਵੇ ਦੇ ਮੁੱਖ ਭਾਗ ਕੁੜਤਾ ਲੰਬੀ ਕਮੀਜ਼ ਪਜਾਮਾ ਜਾਂ ਤੰਬਾ ਫੁਲਕਾਰੀ ਵੇਸ ਜਾਂ ਜੈਕਟ ਦਸਤਾਰ ਕਲੀਰੇ ਹੱਥ ਵਿੱਚ ਪਹਿਨਣ ਵਾਲੇ ਰੁਮਾਲ ਪਰਾਂਦੀ ਧਾਗੇ ਦਾ ਸ਼ਿੰਗਾਰ ਆਦਿ ਹਨ ਇਹ ਭੰਗੜੇ ਦੀ ਸ਼ਾਨ ਨੂੰ ਹੋਰ ਨਿਖਾਰ ਦਿੰਦੇ ਹਨ